ਸਤਿ ਸ਼੍ਰੀ ਅਕਾਲ ਜੀ ਮੈਂ ਚਰਨਜੀਤ ਸਿੰਘ ਬੋਲ ਰਿਹਾ ਜੀ ਮੈਂ ਇੱਕ ਔਡਰ ਦੇਣਾ ਚਾਹੁੰਦਾ ਜੀ ਇੱਕ ਦਾਲ ਮੱਖਣੀ ਅਤੇ ਇੱਕ ਸ਼ਾਹੀ ਪਨੀਰ ਅਤੇ ਦਸ ਰੋਟੀਆਂ ਕਿਰਪਾ ਕਰਕੇ ਇਹ ਮੇਰਾ ਔਡਰ ਮੇਰੇ ਪੁਰਾਣੇ ਐਡਰੈਸ 'ਤੇ ਨਾ ਭੇਜਿਓ ਅਤੇ ਨ ਜੋ ਨਵਾਂ ਡਰੈਸ ਹੈ ਮੋਹਾਲੀ ਸੱਤਰ ਸੈਕਟਰ ਇੱਥੇ ਔਡਰ ਔਡਰ ਡਿਲੀਵਰ ਕੀਤਾ ਜਾਵੇ ਅਤੇ ਜੋ ਇਸ ਦੀ ਪੇਮੈਂਟ ਬਣਦੀ ਹੈ ਉਹ ਆਪਣੇ ਕਿਸੇ ਇੰਪਲਾਈ ਕੋਲ ਬਾਰਕੋਡ ਵਗੈਰਾ ਭੇਜ ਕੇ ਕਲੀਅਰ ਕਰਵਾਇਆ ਜਾਵੇ